ਮੇਰੀ ਡਰਾਇੰਗ ਦੀ ਡੂਡਰ ਕਲਾ ਵਿੱਚ ਖਾਸ ਰੁਚੀ ਹੈ ਅਤੇ ਆਯੂਸ਼ ਕਾਲੜਾ ਨੇ ਮੇਰੇ ਕੰਮ ਨੂੰ ਖਾਸਾ ਪ੍ਰਭਾਵਿਤ ਕੀਤਾ ਹੈਗਾ ਮੈਂ ਉਹਦਾ ਬਹੁਤ ਵੱਡਾ ਫੈਨ ਹੈਗਾ ਆ ਅਤੇ ਮੈਨੂੰ ਉਹ ਬਾਹਲਾ ਪਸੰਦ ਹੈਗਾ ਉਹ ਉਹਨਾਂ ਦਾ ਕੰਮ ਉਹਨੂੰ ਖਾਸਕਰ ਹਿੰਦੁਸਤਾਨ ਟਾਈਮਸ ਅਖਬਾਰ ਵੱਲੋਂ ਵੀ ਕਿਸੇ ਖਾਸੇ ਪੁਰਸਕਾਰ 'ਤੇ ਸਨ ਮਾਨਿਤ ਕੀਤਾ ਗਿਆ ਹੈਗਾ